ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਜਿਦਾਂ ਵਿਸਾਖੀ ਆਉਣ ਲੱਗੀ ਹੈ ਅਤੇ ਉਹਦੇ ਰਿਲੇਟਿਡ ਮੈਂ ਕੁਛ ਇਨਫੋਰਮੇਸ਼ਨ ਲੈਣਾ ਚਾਹੁੰਦਾ ਸੀ ਕਿ ਵਿਸਾਖੀ ਮਨਾਈ ਕਿਉਂ ਜਾਂਦੀ ਹੈ ਅਤੇ ਇਹਦੇ ਅਲ ਰਿਗਾਰਡਿੰਗ ਜਿਹੜਾ ਅਨੰਦਪੁਰ ਸਾਹਿਬ ਦੇ ਉੱਤੇ ਜੋ ਮੇਨ ਆਪਾਂ ਮੰਨਿਆ ਜਾਂਦਾ ਕਿ ਮੇਲਾ ਲੱਗਦਾ ਹੈਗਾ ਉਹਦੇ ਲਈ ਕੁਛ ਦੱਸ ਸਕਦੇ ਹੋ ਮੈਨੂੰ ਹਾਂਜੀ ਹਾਂਜੀ ਮੈਮ ਜਿਹੜਾ ਹੋਲਾ ਮਹੱਲਾ ਹੈਗਾ ਹੈ ਅਤੇ ਹੋਲਾ ਮਹੱਲਾ ਦਾ ਡਿਫਰੈਂਟ ਕਰ ਚੀਜ਼ਾਂ ਕਰਕੇ ਅਲੱਗ ਚੀਜ਼ਾਂ ਕਰਕੇ ਥੋੜ੍ਹਾ ਮਸ਼ਹੂਰ ਹੋਇਆ ਕਿ ਉਹ ਵੀ ਇਹਦੇ ਨਾਲ ਦਾ ਹੀ ਇੱਕ ਪਾਰਟ ਸੀਗਾ ਅੱਛਾ ਜੀ ਮਤਲਬ ਉਹ ਖਾਲਸਾ ਪੰਥ ਤੋਂ ਪਹਿਲਾਂ ਕੋਈ ਵੀ ਸਰਦਾਰ ਮਤਲਬ ਨਹੀਂ ਸੀਗਾ ਸਰਦਾਰ ਸੀਗਾ ਬਟ ਕੋਈ ਉਸ ਪਗੜੀ ਦਾੜੀ ਕੰਘਾ ਕੇਸ ਉਹ ਨਹੀਂ ਰੱਖਦੇ ਸੀਗੇ

ਇੱਕ ਮੈਮ ਜਿਹੜਾ ਖਾਲਸਾ ਪੰਥ ਤੁਸੀਂ ਕਹਿੰਦੇ ਪਏ ਹੋ ਉਹ ਵੋਰਿਆਰ ਕਲਾਸ ਨੂੰ ਹੀ ਮੰਨਿਆ ਜਾਂਦਾ ਹੈ ਕਿ ਜਿਹੜੇ ਨੋਰਮਲ ਬੰਦੇ ਸੀ ਕਿ ਉਹਨਾਂ ਨੂੰ ਵੀ ਸੇਮ ਵਿੱਚ ਹੀ ਮੰਨਿਆ ਜਾਂਦਾ ਉਹ ਅਲੱਗ ਖਾਲਸਾ ਪੰਥ ਜਿਹੜਾ ਖਾਲਸਾ ਦੀ ਫੌਜ ਕਹੀ ਜਾਂਦੀ ਹੈ

ਹਾਂਜੀ ਚਲੋ ਥੈਂਕ ਯੂ ਮੈਮ ਓਕੇ ਬਾਏ ਮੈਮ